ਹਾਂਜੀ ਤੁਸੀਂ ਬਰਨਾਲਾ ਬਰਨਾਲਾ ਤੋਂ ਬੋਲਦੇ ਆ ਜੀ ਹਾਂਜੀ ਅਤੇ ਮੈਮ ਮੈਂ ਗੱਲ ਕਰਨੀ ਸੀਗੀ ਮੈਨੇ ਨਾ ਮੈਂ ਇੱਧਰ ਮੈਂ ਪਟਿਆਲਾ ਲਈ ਪਟਿਆਲੇ ਤੋਂ ਬੋਲਦੀ ਹਾਂ ਹਾਂਜੀ ਮੈਮ ਮੈਂ ਨਾ ਇੱਧਰ ਬਰਨਾਲਾ ਵਿੱਚ ਆਪਦੀ ਐਡਮਿਸ਼ਨ ਲੈਣੀ ਸੀ ਇੱਥੋਂ ਦਾ ਕੋਈ ਕੋਈ ਵੀ ਤੁਸੀਂ ਇੱਧਰੋਂ ਕੋਈ ਵੀ ਕੋਲਜ ਦੱਸ ਦਿਉ ਵੀ ਕੋਈ ਵੀ ਜਿਹੜੇ 'ਚ ਵੀ ਵਧੀਆ ਹੈਂ ਮੈਨੇ ਕੋਈ ਵੀ ਬਸ ਵਧੀਆ ਉਹ ਹੋ ਜੇ ਹਾਂਜੀ ਅਤੇ ਇੱਥੇ ਮੇਰੇ ਫ੍ਰੈਂਡ ਵੀ ਇੱਥੇ ਹੀ ਲੱਗੇ ਹੋਏ ਨੇਗੇ ਉਹਨਾਂ ਨੇ ਵੀ ਇੱਥੇ ਹੀ ਉਹ ਜ ਉਹ ਕੀਤੀ ਹੈ ਪੜ੍ਹਾਈ ਕੀਤੀ ਹੈਗੀ ਹਾਂਜੀ ਹਾਂਜੀ ਬੀ ਸੀ ਏ ਹਾਂਜੀ ਹਾਂਜੀ ਮੈਂ ਵੀ ਬੀ ਸੀ ਏ ਕਰਨੀ ਆ ਹਾਂਜੀ ਅਤੇ ਤੁਸੀਂ ਮੈਨੂੰ ਦੱਸ ਦਿਓ ਇੱਥੇ ਕਿਹੜਾ ਕੋਲਜ ਵਧੀਆ ਵੀ ਜਿਹੜਾ ਵੀ ਵਧੀਆ ਹੋਵੇ ਐਜੂਕੇਸ਼ਨ ਵਧੀਆ ਹੋਵੇ ਉਹਦੀ ਓਕੇ ਜੀ ਹਾਂਜੀ

ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ ਜੀ ਓਕੇ ਜੀ

ਓਕੇ ਜੀ ਹੋਰ ਜੀ ਓਕੇ ਜੀ ਓਕੇ ਅਤੇ ਮੈਮ ਆਪਣੇ ਇੱਧਰ ਹਾਂਜੀ ਓਕੇ ਜੀ ਓਕੇ ਜੀ ਓਕੇ ਓਕੇ ਓ ਓਕੇ ਜੀ ਓਕੇ ਜੀ ਹਾਂਜੀ ਅਤੇ ਵੀ ਇਹਨਾਂ ਦੇ ਟਾਈਮਿੰਗ ਕੀ ਹੈ ਮੈਮ ਓਕੇ ਜੀ ਓਕੇ ਜੀ ਹਾਂਜੀ ਹਾਂਜੀ ਮੈਮ ਮੈਂ ਨਾ ਦੋ ਵਜੇ ਤੋਂ ਬਾਅਦ ਵੀ ਜਦੋਂ ਇੱਧਰੋਂ ਕੋਲਜ ਓਫ਼ ਹੋ ਜਾਇਆ ਕਰੇ ਤਾਂ ਮੈਂ ਆਈਲੈਟਸ ਦੀ ਕਲਾਸ ਸ਼ੁਰੂ ਕਰਨੀ ਹੈ ਇੱਧਰ ਵੀ ਉਹਦੇ ਬਾਰੇ ਵੀ ਹਾਂਜੀ ਵੀ ਉਹ ਪੁੱਛਣਾ ਹੀ ਸੀਗਾ ਬਸ ਹਾਂਜੀ ਓਕੇ ਜੀ ਓਕ ਓਕੇ ਜੀ ਓਕੇ ਜੀ ਓਕੇ ਠੀਕ ਹੈ ਜੀ ਓਕੇ ਜੀ ਓਕੇ ਠੀਕ ਹੈ ਜੀ ਓਕੇ ਜੀ ਓਕੇ ਜੀ ਮੈਮ ਥੈਂਕ ਯੂ ਜੀ ਠੀਕ ਹੈ ਓਕੇ ਜੀ